ਪੰਜਾਬੀ ਭਾਸ਼ਾ ਇੱਕ ਇੱਦਾਂ ਜੀ ਭਾਸ਼ਾ ਜਿਹਦੇ 'ਚ ਇੱਕ ਆਪਣਾ ਪਣ ਆਉਂਦਾ ਕਿਸੇ ਨਾਲ ਵੀ ਗੱਲ ਕਰੀਏ ਉਹਦੇ 'ਚ ਲੱਗੇਗਾ ਕਿ ਅਸੀਂ ਇੱਕ ਆਪਣੇ ਬੰਦੇ ਦੇ ਨਾਲ ਗੱਲ ਕਰ ਰਹੇ ਹਾਂ ਉਹਨਾਂ ਨੂੰ ਵੀ ਆਪਣਾ ਪਣ ਆਉਂਦਾ ਉਹਨਾਂ ਦੇ ਵਿੱਚ ਸਾਡੀ ਪੰਜਾਬੀ ਭਾਸ਼ਾ ਹਮੇਸ਼ਾ ਹੀ ਸਾਰੇ ਪਾਸੇ ਬੜੇ ਪਿਆਰ ਅਤੇ ਇੱਜ਼ਤ ਦੇ ਨਾਲ ਬੋਲੀ ਜਾਂਦੀ ਹੈ ਅਤੇ ਲੋਕਾਂ ਨੂੰ ਇਹਨਾਂ ਨੂੰ ਬੋਲਣ 'ਚ ਇਹਨਾਂ ਨੂੰ ਸਮਝਣ 'ਚ ਕੋਈ ਵੀ ਮੁਸ਼ਕਲਾਂ ਨਹੀਂ ਆਉਂਦੀਆਂ